ਮੈਂ ਕਲਾਕਾਰੀ ਜੇ ਚਿੱਤਰਕਾਰੀ ਮੈਂ ਬਚਪਨ ਤੋਂ ਸ਼ੁਰੂ ਕੀਤੀ ਸੀਗੀ ਆ ਅਤੇ ਇਹਦੇ 'ਚ ਮੇਰੀ ਰੁਚੀ ਜਗਾਉਣ ਲਈ ਮੇਰੀ ਮਾਤਾ ਜੀ ਦਾ ਬਹੁਤ ਵੱਡਾ ਹੱਥ ਹੈਗਾ ਅਤੇ ਮੈਂ ਉਹਨਾਂ ਨੂੰ ਆਪਣਾ ਮਨ ਪਸੰਦ ਕਲਾਕਾਰ ਮੰਨ ਰਿਹਾ